ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਬਹੁਤ ਹੀ ਥਾਵਾਂ 'ਤੇ ਮਨੋਰੰਜਕ ਵਿਕਲਪਸ ਬਹੁਤ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦਿਵਾਲੀ ਅੱਗੇ ਆ ਰਹੀ ਹੈ ਉਹ ਕਹਾਵਤ ਬਹੁਤ ਮਸ਼ਹੂਰ ਹੈ ਕਿ ਦਾਲ ਰੋਟੀ ਘਰ ਦੀ ਦਿਵਾਲੀ ਅੰਬਰਸਰ ਦੀ ਆਪਾਂ ਅੰਬਰਸਰ ਦੀ ਗੱਲ ਕਰੀਏ ਤਾਂ ਅੰਬਰਸਰ ਦੇ ਵਿੱਚ ਦਿਵਾਲੀ ਬਹੁਤ ਹੀ ਜ਼ਿਆਦਾ ਧੂਮਧਾਮ ਨਾਲ ਮਨਾਈ ਜਾਂਦੀ ਹੈ ਕਿਉਂਕਿ ਇਸ ਦਿਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਿੱਖਾਂ ਦੇ ਛੇਵੇਂ ਗੁਰੂ ਜਹਾਂਗੀਰ ਦੀ ਕੈਦ ਤੋਂ ਰਿਹਾਅ ਹੋਏ ਸਨ ਤਾਂ ਉਹਨਾਂ ਨੇ ਨਾਲ ਆਪ ਜਦੋਂ ਰਿਹਾਅ ਹੋਏ ਸਨ ਉਹਨਾਂ ਨੇ ਆਪਣੇ ਨਾਲ ਨਾਲ ਇਕਵੰਜਾ ਰਾਜਿਆਂ ਨੂੰ ਵੀ ਛੁਡਵਾਇਆ ਸੀ ਅਤੇ ਉਸ ਤੋਂ ਬਾਅਦ ਉਸ ਕਰਕੇ ਅੰਬਰਸਰ ਦੇ ਵਿੱਚ ਬਹੁਤ ਹੀ ਭਾਰੀ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਦਿਵਾਲੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ